ਸਤਿ ਸ਼੍ਰੀ ਅਕਾਲ ਜੀ ਹੋਰ ਸਣਾਓ ਠੀਕ ਹੋ ਭਾਅ ਜੀ ਹਾਂਜੀ ਹਾਂਜੀ ਸਭ ਵਧੀਆ ਠੀਕ ਠਾਕ ਆ ਜੀ ਦੇਖੋ ਜੀ ਜੇ ਤਾਂ ਵਧੀਆ ਸਕੂਲ ਦੀ ਗੱਲ ਕਰਦੇ ਹੋ ਤਾਂ ਆਪਣੇ ਇੱਥੇ ਸੀਕ੍ਰੇਟ ਹਾਰਟ ਹੈ ਨਾ ਕੌਨਵੈਂਟ ਸਕੂਲ ਰਾਏਕੋਟ ਰੋਡ 'ਤੇ ਹਾਂਜੀ ਉਹ ਉਹ ਬਹੁਤ ਅੱਛਾ ਉਹ ਵੈਂਥਨੀ ਵਾਲਿਆਂ ਦਾ ਵਾ ਨੰਨਸ ਚਲਾਉਂਦੇ ਨੇ ਬੈਂਗਲੌਰ ਦੀ ਉਹ ਨੰਨਸ ਨੇ ਉਹ ਉਹਨਾਂ ਦੀ ਚੈਰੀਟੇਬਲ ਹੁੰਦਾ ਵਾ ਇਹ ਟਰੱਸਟ ਹੀ ਆ ਉਹ ਸਕੂਲ ਸਾਰਿਆਂ ਨਾਲੋਂ ਵਧੀਆ ਵਾ ਥੋੜ੍ਹੇ ਲੋਕਲ ਵੀ ਹੈਗੇ ਨੇ ਪਰ ਜਿਹੜਾ ਪ੍ਰਿੰਸੀਪਲ ਅਤੇ ਇਹਨਾਂ ਦੀ ਵਾਈਸ ਪ੍ਰਿੰਸੀਪਲ ਅਤੇ ਜਿਹੜੇ ਕੋਆਰਡੀਨੇਟਰ ਨੇ ਉਹ ਨੰਨਸ ਖੁਦ ਹੀ ਨੇ ਉਹ ਆਪ ਹੀ ਚਲਾਉਂਦੇ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬ ਬਸ ਐਂ ਵਾ ਕਿ ਰੈਜਿਸਟ੍ਰੇਸ਼ਨ ਹੋਏ ਇਹ ਇੱਕ ਵਾਰੀ ਭਰਾਉਂਦੇ ਹੈ ਪੰਜ ਹਜ਼ਾਰ ਰੁਪਈਆ ਉਹ ਇੱਕ ਟਾਈਮ ਹੀ ਭਰਾਉਂਦੇ ਹੈ ਉਹ ਅਤੇ ਉਸ ਤੋਂ ਬਾਅਦ ਸਿਰਫ਼ ਕ ਇਕੱਲੀ ਫੀਸ ਹੀ ਜਾਂਦੀ ਹੈ ਤਿੰਨ ਚਾਰ ਚਾਰ ਮਹੀਨਿਆਂ ਦੀ ਨਹੀਂ ਨਹੀਂ ਕੁਆਟਰਲੀ ਕੁਆਟਰਲੀ ਚਾਰ ਚਾਰ ਮਹੀਨਿਆਂ ਦੀ ਜਾਂਦੀ ਹੈ ਤਿੰਨ ਕਿਸ਼ ਤਿੰਨ ਇੰਸਟੋਲਮੈਂਟਸ ਜਾਂਦੀਆਂ ਨੇ ਬੱਚਿਆਂ ਦੀਆਂ ਹਾਂਜੀ

ਹਾਂਜੀ ਹਾਂਜੀ ਬਾਕੀ ਸਕੂਲ ਬਹੁਤ ਵਧੀਆ ਵਾ ਬੋਡ ਸੀ ਬੀ ਐੱਸ ਈ ਬੋਡ ਹੈ ਜੀ ਇਹ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰਾ ਕੁਛ ਵਧੀਆ ਬੱਚਾ ਇੰਡਿਪੈਂਡੈਂਟ ਹੋ ਜਾਂਦਾ ਡਿਸਪਲਿਨ ਹੋ ਜਾਂਦਾ ਖੁਦ ਆਪਦੇ ਕੰਮ ਕਰਨ ਲੱਗ ਪੈਂਦਾ ਹੋਰ ਪੇਰੈਂਟਸ ਨੂੰ ਹੋਰ ਕੀ ਚਾਹੀਦਾ ਹੁੰਦਾ ਇਹੀ ਚੀਜ਼ ਚਾਹੀਦੀ ਹੈ ਹਾਂ ਬਸ ਹਾਂਜੀ ਹਾਂਜੀ ਇਹੀ ਚੀਜ਼ ਹੁੰਦੀ ਹੈ ਹਾਂਜੀ ਬਾਕੀ ਸਕੂਲ ਵੀ ਤਾਂ ਹੋਰ ਤਾਂ ਹੈਗੇ ਨੇ ਬਥੇਰੇ ਨੇ ਬਰਨਾਲੇ 'ਚ ਪਰ ਬੈਸਟ ਇਹੀ ਹੈ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਬਾਕੀ ਸਟ੍ਰਿਕਨੈੱਸ ਬਹੁਤ ਜ਼ਿਆਦਾ ਹੈ ਸੀਕ੍ਰੇਟ ਹਾਰਟ 'ਚ ਤਾਂ ਹਾਂਜੀ ਸਟ੍ਰਿਕਨੈੱਸ ਬਹੁਤ ਜ਼ਿਆਦਾ ਹੈ ਤੁਸੀਂ ਇਹ ਦੇਖੋ ਵੀ ਬੱਚੇ ਦੀ ਅਡਮੀਸ਼ਨ ਹੋਣ ਤੋਂ ਪਹਿਲਾਂ ਪੇਰੈਂਟਸ ਦੀ ਇੰਟਰਵਿਊ ਹੁੰਦੀ ਇੱਥੇ ਹਾਂਜੀ ਹਾਂ ਵੀ ਪੜ੍ਹਾ ਸਕਦੇ ਹੈ ਕਿ ਨਹੀਂ ਪੜ੍ਹਾ ਸਕਦੇ ਹਾਂ ਹਾਂਜੀ ਹਾਂਜੀ ਉਹੀ ਟੂਸ਼ਨ ਰੱਖ ਸਕਦੇ ਹਾਂਜੀ ਕੋਈ ਗੱਲ ਨਹੀਂ ਤੁਸੀਂ ਬੱਚਾ ਬੇਫਿਕਰ ਹੋ ਕੇ ਪਾ ਦਿਉ ਇੱਥੇ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ